ਹਾਂਜੀ ਸਤਿ ਸ਼੍ਰੀ ਅਕਾਲ ਬੋਲੋ ਕੌਣ ਕਿਉਂ ਤੁਸੀਂ ਕੀ ਕਰਨਾ ਜੀ ਅੱਛਾ ਅੱਛਾ ਅਤੇ ਵੈਸੇ ਜ਼ਿਆਦਾਤਰ ਹਾਂ ਹਾਂ ਕੋਈ ਨਹੀਂ ਜ਼ਿਆਦਾਤਰ ਸ਼ੂਟਿੰਗ ਮਤਲਬ ਕਿ ਖਾਲਸਾ ਕੋਲਜ ਵਗੈਰਾ ਚੰਡੀਗੜ੍ਹ ਯੂਨੀਵਰਸਿਟੀ ਜੀ ਐੱਨ ਡੀ ਯੂ ਯੂਨੀਵਰਸਿਟੀ ਜਿਹੜੀ ਉਹ 'ਚ ਹੁੰਦੀਆਂ ਨੇ ਅਤੇ ਕਾਫੀ ਸਾਰੀਆਂ ਫਿਲਮਾਂ ਜਿਵੇਂ ਕਿ ਸ਼ੂਟਰ ਰੰਗ ਦੇ ਬਸੰਤੀ ਗ਼ਦਰ ਹੋਰ ਵੀ ਤਾਂ ਚਿੜੀਆਂ ਦਾ ਚੰਬਾ ਸਾਰੀਆਂ ਇੱਥੇ ਹੀ ਹੋਈਆਂ ਨੇ ਤੁਸੀਂ ਕਦੀ ਵੀ ਮਤਲਬ ਕਿ ਚੱਲ ਜਾਇਓ ਪਰ ਐਤਕੀਂ ਜੇ ਜਾਣ ਤੋਂ ਪਹਿਲੇ ਨਾ ਜਿਹੜੇ ਵੀ ਕੋਲਜ ਦੇ ਵਗੈਰਾ ਦੇ ਗੇਟ ਉਹਨੂੰ ਪੁੱਛ ਲਿਓ ਵੀ ਸ਼ੂਟਿੰਗ ਦਾ ਟਾਈਮ ਕੀ ਹੈ ਕਿ ਕਦੀ ਕਦੀ ਉੱਥੇ ਸ਼ੂਟਿੰਗ ਨਹੀਂ ਹੋਣ ਡਈ ਹੁੰਦੀ ਨਾ ਤਾਂ ਉਹਨੂੰ ਪੁੱਛ ਲਿਓ ਹਾਂ ਚਲੋ ਕੋਈ ਨਹੀਂ ਮੈ ਦਸ ਦਉਂਗਾ ਚੰਗਾ ਓਕੇ ਬਾਏ